ਮੈਂ ਇਹ ਮੰਨਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਫੋਟੋਗ੍ਰਾਫੀ ਬਹੁਤ ਜ਼ਿਆਦਾ ਵੱਡਾ ਰੋਲ ਪਲੇਅ ਕਰ ਰਹੀ ਹੈ ਫੋਟੋਗ੍ਰਾਫੀ ਅੱਜ ਉਸ ਮੁਕਾਮ 'ਤੇ ਜਾ ਚੁੱਕੀ ਹੈ ਲੋਕ ਕਰੋੜਾਂ ਰੁਪਏ ਇਸ ਤੋਂ ਕਮਾ ਰਹੇ ਹਨ ਜਿਵੇਂ ਕਿ ਲੋਕ ਵਲੋਗ ਬਣਾਉਂਦੇ ਹਨ ਉਸ ਨੂੰ ਯੂਟਿਊਬ 'ਤੇ ਪਾਉਂਦੇ ਹਨ ਅਤੇ ਜਿਸ ਨਾਲ ਕਿ ਲੱਖਾਂ ਹੀ ਲੋਕ ਉਸ ਚੀਜ਼ ਤੋਂ ਇੰਟਰਟੇਨਮੈਂਟ ਲੈਂਦੇ ਹਨ ਅਤੇ ਦੇਖਦੇ ਹਨ ਅਤੇ ਬਹੁਤ ਕੁਝ ਸਿੱਖਦੇ ਵੀ ਹਨ ਸੋ ਫੋਟੋਗ੍ਰਾਫੀ ਬਹੁਤ ਹੀ ਵੱਡਾ ਰੋਲ ਪਲੇਅ ਕਰ ਰਹੀ ਹੈ ਮੈਂ ਇੱਕ ਅਕਾਊਂਟ ਨੂੰ ਫੋਲੋ ਕਰਦਾ ਹਾਂ ਜੋ ਕਿ ਇੱਕ ਲੜਕਾ ਹੈ ਸਤਵਿੰਦਰ ਸਿੰਘ ਵੜੈਚ ਉਹ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਉਸ ਨੂੰ ਫੋਟੋਗ੍ਰਾਫੀ ਦੀ ਬਹੁਤ ਡੈਫਥ ਨੌਲੇਜ ਨੌਲੇਜ ਹੈ ਅਤੇ ਉਹ ਇਨਫਲੂਐਂਸਰ ਵੀ ਹੈ ਲੋਕਾਂ ਨੂੰ ਦੱਸਦਾ ਹੈ ਕਿ ਕਿਵੇਂ ਫੋਟੋਸ ਨੂੰ ਕਲਿੱਕ ਕੀਤਾ ਜਾਂਦਾ ਹੈ ਵੱਖਰੀ ਵੱਖਰੀ ਸਿਚੁਏਸ਼ਨਸ ਦੇ ਵਿੱਚ ਕਿੰਨਾ ਟਾਈਮ ਮਾਈਕਰੋਨ ਕਿੰਨੇ ਟਾਈਮਿੰਗ ਸੈੱਟ ਰੱਖ ਕੇ ਆਪਾਂ ਫੋਟੋ ਨੂੰ ਕਲਿੱਕ ਕਰ ਸਕਦੇ ਹਾਂ ਅਤੇ ਉਹ ਹੋਰ ਵੀ ਤਰੀਕੇ ਦੇ ਨਾਲ ਕਿਵੇਂ ਫੋਟੋਗ੍ਰਾਫੀ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਦੀ ਮੋਟੀਵੇਸ਼ਨ ਦਿੰਦਾ ਹੈ ਅਤੇ ਨੌਲੇਜ ਵੀ ਦਿੰਦਾ ਹੈ